ਪੋਲੀਓ ਕੀ ਹੈ ਪੋਲੀਓ ਇੱਕ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਇਹ ਵਾਇਰਸ ਕਿਸੇ ਬੱਚੇ ਦੇ ਸਰੀਰ ਵਿੱਚ ਮੂੰਹ ਰਾਹੀਂ ਦਾਖਲ ਹੁੰਦਾ ਹੈ ਕਦੇ ਕਦੇ ਇਸ ਨਾਲ ਕੋਈ ਗੰਭੀਰ ਬਿਮਾਰੀ ਨਹੀਂ ਹੁੰਦੀ ਪਰ ਕਦੇ ਕਦੇ ਇਸ ਨਾਲ ਅਧਰੰਗ ਹੋ ਜਾਂਦਾ ਹੈ ਇਸ ਨਾਲ ਬਿਮਾਰੀ ਲੱਗੇ ਲੋਕਾਂ ਦੀ ਮੌਤ ਹੋ ਸਕਦੀ ਹੈ ਅਤੇ ਅਜਿਹਾ ਆਮ ਤੌਰ 'ਤੇ ਉਹਨਾਂ ਪੱਠਿਆਂ ਨੂੰ ਅਧਰੰਗ ਹੋਣ ਨਾਲ ਹੁੰਦਾ ਹੈ ਜਿਹੜੇ ਉਹਨਾਂ ਵਿਅਕਤੀ ਦੀ ਸਾਹ ਲੈਣ ਵਿੱਚ ਮਦਦ ਕਰਦੇ ਹਨ ਯੂਨਾਈਟੇਡ ਸਟੇਟਸ ਵਿੱਚ ਇੱਕ ਵੇਲੇ ਪੋਲੀਓ ਇੱਕ ਆਮ ਬਿਮਾਰੀ ਹੁੰਦੀ ਸੀ ਜਿਸ ਦਾ ਵੈਕਸੀਨੇਸ਼ਨ ਲੱਭਣ ਤੋਂ ਇੱਕ ਸਾਲ ਪਹਿਲਾਂ ਇਸ ਬਿਮਾਰੀ ਨਾਲ ਹਜ਼ਾਰਾਂ ਲੋਕਾਂ ਨੂੰ ਅਧਰੰਗ ਹੋਇਆ ਇਹ ਬਿਮਾਰੀ ਉਹਨਾਂ ਦੀ ਮੌਤ ਦਾ ਕਾਰਨ ਬਣੀ ਦੁਨੀਆ ਦੇ ਉਹਨਾਂ ਇਲਾਕਿਆਂ ਵਿੱਚ ਜਾਣ ਵਾਲੇ ਲੋਕ ਜਿੱਥੇ ਪੋਲੀਓ ਆਮ ਹੈ ਲੈਬਾਟੀ ਵਿੱਚ ਕੰਮ ਕਰਦੇ ਵਰਕਰ ਜਿਹੜੇ ਪੋਲੀਓ ਦੇ ਵਾਇਰਸ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਉਹਨਾਂ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹੈਲਥ ਕੇਅਰ ਵਰਕਰ ਜਿਹਨਾਂ ਨੂੰ ਪੋਲੀਓ ਹੋ ਸਕਦਾ ਹੈ ਪੋਲੀਓ ਤੋਂ ਕਿਵੇਂ ਬਚਿਆ ਜਾਵੇ ਪੋਲੀਓ ਤੋਂ ਬਚਣ ਲਈ ਸਾਨੂੰ ਵੱਖ ਵੱਖ ਤਰ੍ਹਾਂ ਦੇ ਜੋ ਕੈਂਪ ਮੁਹੱਈਆ ਕਰਾਏ ਜਾਂਦੇ ਹਨ ਉੱਥੇ ਬੱਚੇ ਨੂੰ ਲਿਜਾ ਕੇ ਬੂੰਦਾਂ ਪਵਾਈਆਂ ਜਾਣ ਹਰ ਹਫਤੇ ਬੂੰਦਾ ਪਵਾਈਆਂ ਜਾਣ ਤਾਂ ਜੋ ਬੱਚੇ ਪੋਲੀਓ ਤੋਂ ਬਚ ਸਕਣ ਆਪਣੇ ਡਾਕਟਰ ਜਾਂ ਨਰਸ ਨੂੰ ਪੁੱਛੋ ਉਹ ਤੁਹਾਨੂੰ ਵੈਕਸੀਨੇਸ਼ਨ ਬਾਰੇ ਲਿਖਤੀ ਜਾਣਕਾਰੀ ਦੇ ਸਕਦੇ ਹਨ ਪੋਲੀਓ ਦਾ ਲੋਧਾ ਲਵਾਉਣ ਵਾਲੇ ਕੁਝ ਲੋਕਾਂ ਦੇ ਲੋਧਾ ਲਵਾਉਣ ਵਾਲੀ ਥਾਂ ਦੁਖਦੀ ਹੈ ਅੱਜ ਕੱਲ੍ਹ ਵਰਤੀ ਜਾਂਦੀ ਵੈਕਸੀਨੈਸਨ ਨਾਲ ਕੋਈ ਵੀ ਗੰਭੀਰ ਬਿਮਾਰੀ ਨਹੀਂ ਹੁੰਦੀ ਅਤੇ ਬਹੁਤੇ ਲੋਕਾਂ ਦੀ ਇਸ ਨਾਲ ਬਿਲਕੁਲ ਕੋਈ ਸਮੱਸਿਆ ਨਹੀਂ ਆਉਂਦੀ ਫਿਰ ਵੀ ਕਿਸੇ ਵੀ ਬਿਮਾਰੀ ਦਾ ਲੋਧਾ ਕਿਸੇ ਵੀ ਦਵਾਈ ਵਾਂਗ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜਿਵੇਂ ਕਿ ਐਲਰਜੀ ਦਾ ਗੰਭੀਰ ਰਿਐਕਸ਼ਨ ਹੋਣਾ ਪੋਲੀਓ ਦੇ ਲੋਧੇ ਨਾਲ ਨੁਕਸਾਨ ਜਾਂ ਮੌਤ ਹੋਣ ਦੇ ਖਤਰੇ ਘੱਟ ਜਾਂਦੇ ਹਨ ਮੈਨੂੰ ਕੀ ਦੇਖਣਾ ਚਾਹੀਦਾ ਹੈ ਮੈਨੂੰ ਦੇਖਣਾ ਚਾਹੀਦਾ ਹੈ ਕੋਈ ਵੀ ਆਸਾਧਾਰਨ ਹਾਲਾਤ ਜਿਵੇਂ ਕਿ ਅਲਰਜੀ ਦਾ ਗੰਭੀਰ ਰਿਐਕਸ਼ਨ ਹੋਣਾ ਤੇਜ਼ ਬੁਖਾਰ ਜਾਂ ਵਤੀਰੇ ਵਿੱਚ ਤਬਦੀਲੀਆਂ ਅਲਰਜੀ ਦਾ ਜੇ ਗੰਭੀਰ ਰਿਐਕਸ਼ਨ ਹੋਵੇ ਤਾਂ ਇਹ ਲੋਧਾ ਲੱਗਣ ਤੋਂ ਬਾਅਦ ਕੁਝ ਮਿੰਟ ਤੋਂ ਲੈ ਕੇ ਕੁਝ ਘੰਟਿਆਂ ਵਿੱਚ ਹੋਵੇਗਾ ਅਲਰਜੀ ਦੇ ਗੰਭੀਰ ਰਿਐਕਸ਼ਨ ਦੀਆਂ ਨਿਸ਼ਾਨੀਆ ਵਿੱਚ ਸਾਹ ਲੈਣ ਵਾਲੀ ਔਖਾਈ ਕਮਜ਼ੋਰੀ ਘੱਟ ਅਵਾਜ਼ ਜਾਂ ਸੁੱਕਣ ਦਿਲ ਦਾ ਤੇਜ਼ ਧੜਕਣਾ ਛਪਾਕੀ ਚੱਕਰ ਆਉਣੇ ਚਿਹਰੇ 'ਤੇ ਫਿਰਨੀ ਜਾਂ ਸੰਗ ਦੀ ਸੋਚ ਸ਼ਾਮਿਲ ਹੋ ਸਕਦੇ ਹਨ ਧੰਨਵਾਦ